ਹੈਲੋ ਹਾਂਜੀ ਕੀ ਹਾਲ ਹੈ ਹਾਂਜੀ ਹਾਂ ਵਧੀਆ ਅਤੇ ਮੈਂ ਨਾ ਇੱਦਾਂ ਕਹਿੰਦੀ ਸੀ ਕਿ ਮੈਂ ਨਾ ਹੁਣ ਪੋਸਟ ਗ੍ਰੈਜੂਏਸ਼ਨ 'ਚ ਐਡਮਿਸ਼ਨ ਲਿੱਤੀ ਹੈ ਇੱਥੇ ਪਟਿਆਲਾ ਲਿੱਤੀ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਅਤੇ ਮੈਨੂੰ ਨਾ ਪੀ ਜੀ ਦੇਖਣਾ ਕੋਈ ਤਾਂ ਤੁਸੀਂ ਉੱਥੇ ਦੇ ਲੋਕਲ ਹੋਂ ਤਾਂ ਤੁਹਾਨੂੰ ਤਾਂ ਪਤਾ ਹੀ ਹੋਊਗਾ ਕਿ ਕਿੱਧਰ ਹੈਗੇ ਨੇ ਵਧੀਆ ਪੀ ਜੀ ਤਾਂ ਤੁਸੀਂ ਦੱਸ ਸਕਦੇ ਹੋ ਉਹ ਨਹੀਂ ਨਹੀਂ ਹੋਸਟਲ ਨਹੀਂ ਮੈਂ ਪੀ ਜੀ ਹੀ ਲੈਣਾ ਨਾ ਹੋਸਟਲ ਵਿੱਚ ਨਾ ਖਾਣਾ ਵਗੈਰਾ ਨਹੀਂ ਇੰਨਾ ਵਧੀਆ ਹੁੰਦਾ ਹਾਂਜੀ ਅਤੇ ਇਸ ਕਰਕੇ ਮੈਂ ਜੀ ਹੀ ਸੋਚ ਰਹੀ ਸੀਗੀ ਮੈਂ ਤਾਂ ਇੱਥੇ ਹੀ ਹਾਂ ਵੈਸੇ ਮੈਂ ਹਜੇ ਆਪਣੀ ਕਜ਼ਨ ਕੋਲ ਰਹਿ ਰਹੀ ਹਾਂ ਅਤੇ ਉਹਨੇ ਵੀ ਮਤਲਬ ਉਹ ਵੀ ਓ ਚੰਡੀਗੜ੍ਹ ਪੜ੍ਹਦੀ ਹੈ ਅਤੇ ਉਹਨੇ ਉੱਥੇ ਚਲੇ ਜਾਣਾ ਫਿਰ ਮੈਨੂੰ ਇੱਦਾਂ ਸੀਗਾ ਕਿ ਮੈਂ ਤਾਂ ਫਿਰ ਜੀ ਦਾ ਦੇਖਲਾਂ ਹੈ ਨਾ ਕਿ ਦ ਤੁਸੀਂ ਦੱਸ ਦਿਉ ਕਦੋਂ ਫ੍ਰੀ ਹੋਂ ਅੱਛਾ ਅੱਛਾ ਅੱਛਾ ਅਤੇ ਫਿਰ ਤੁਸੀਂ ਦੇਖ ਲਿਓ ਵੀਕਐਂਡ ਆ ਜਾਇਓ ਸੈਚਡੇ ਜਾਂ ਸੰਡੇ ਆ ਜਾਇਓ ਅਤੇ ਉਦੋਂ ਫਿਰ ਮੈਨੂੰ ਦਿਖਾ ਦਿਓ ਵੀ ਕਿੱਥੇ ਕੁ ਹੈ ਅਤੇ ਆਪਾਂ ਦੇਖ ਲਾਂਗੇ ਫਿਰ ਵੀ ਕਿਹੜਾ ਵਧੀਆ ਹੈ ਕਿਹੜਾ ਠੀਕ ਰਹਿੰਦਾ ਹੈ ਸ਼ੇਅਰ ਕਰ ਲਾਂਗੇ ਨਹੀਂ ਮੇਰੇ ਨਾਲ ਤਾਂ ਨਹੀਂ ਹੈਗੀ ਕੋਈ ਹਾਂਜੀ ਹਾਂਜੀ ਚੱਲੋ ਉਹ ਮੈਂ ਫਿਰ ਪਤਾ ਕਰ ਲਾਂਗੀ ਕਿਉਂਕਿ ਮੈਂ ਕੱਲ੍ਹ ਨੂੰ ਜਾਣਾ ਯੂਨੀਵਰਸਿਟੀ ਹੈ ਨਾ ਇੱਕ ਦੋ ਹੈਗੀ ਆ ਮੇਰੇ ਨਾਲ ਦੀ ਜੇ ਉਹਨੂੰ ਲੋੜ ਹੋਈ ਫਿਰ ਮੈਂ ਉਹਦੇ ਤੋਂ ਪੁੱਛ ਲਾਂਗੀ ਫਿਰ ਇਕੱਠਿਆਂ ਦਾ ਦੇਖ ਲਾਂਗੇ ਠੀਕ ਹੈ ਹਾਂਜੀ ਠੀਕ ਹੈ ਅਤੇ ਫਿਰ ਤੁਸੀਂ ਦੇਖ ਲਿਓ ਠੀਕ ਹੈ ਵੀਕਐਂਡ 'ਤੇ ਆ ਜਾਇਓ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ